ਸਤਿ ਸ੍ਰੀ ਅਕਾਲ ਮੈਂ ਆਪ ਦੇ ਰੈਸਟੋਰੈਂਟ ਵਿੱਚ ਮਾਂਹ ਅਤੇ ਨਾਲੇ ਦੋ ਪਰੌਂਠਿਆਂ ਦਾ ਆਰਡਰ ਕੀਤਾ ਸੀ ਅਤੇ ਮੈਂ ਹੁਣ ਇੱਕ ਪੇਅ ਪਦਾਰਥ ਜਿਵੇਂ ਕਿ ਕੋਕ ਮੰਗਵਾਉਣਾ ਚਾਹੁੰਦੀ ਹਾਂ ਅਤੇ ਤੁਹਾਡੇ ਕੋਲ ਕੀ ਕਿਹੜੇ ਕਿਹੜੇ ਪੀਣ ਵਾਲੇ ਪਦਾਰਥ ਹਨ ਜਿਵੇਂ ਕਿ ਕੋਕ ਹੋ ਗਿਆ ਜੂਸ ਹੋ ਗਿਆ ਹੋਰ ਲਾਈਮ ਜੂਸ ਹੋ ਗਿਆ ਤੁਹਾਡੇ ਵਿੱਚ ਕੀ ਕੀ ਨੇ ਕੋਕ ਹੈਗੀ ਹੈ ਜਾਂ ਜੂਸ ਹੈਗਾ ਕੋਕ ਕੋਕ ਹੈਗੀ ਹੈ ਤਾਂ ਠੀਕ ਹੈ ਮੈਨੂੰ ਇਹਦੇ ਨਾਲ ਇੱਕ ਕੋਕ ਓਡਰ ਕਰ ਦਿੱਤੀ ਜਾਵੇ ਮੈਂ ਇੱਕ ਨਾਲ ਇੱਕ ਕੋਕ ਵੀ ਲੈਣਾ ਚਾਹੁੰਦੀ ਹੈ ਪ ਪਹਿਲੇ ਜਿਹੜੇ ਮਾਂਹ ਅਤੇ ਪਰੌਂਠੇ ਮੈਂ ਆਰਡਰ ਕੀਤੇ ਸੀ ਉਹਦੀ ਪੇਮੈਂਟ ਤਾਂ ਮੈਂ ਕਰ ਚੁੱਕੀ ਹਾਂ ਅਤੇ ਜਿਹੜੇ ਇਹ ਕੋਕ ਹੈਗੀ ਆ ਇਸਦਾ ਓਰਡਰ ਮੈਂ ਤੁਹਾਨੂੰ ਜਦੋਂ ਮੇਰੇ ਕੋਲ ਕੋਕ ਅਤੇ ਨਾਲੇ ਪਰੌਂਠੇ ਆ ਜਾਣਗੇ ਇਸ ਤੋਂ ਬਾਅਦ ਮੈਂ ਤੁਹਾਨੂੰ ਕੋਕ ਦੀ ਜਿਹੜੀ ਪੇਮੈਂਟ ਹੈ ਉਹ ਕਰ ਦੇਵਾਂਗੀ ਇਸ ਕਰਕੇ ਮੈਨੂੰ ਜਿਹੜੇ ਹੈ ਇਸ ਭੋਜਨ ਮਾਂਹ ਅਤੇ ਪਰੌਂਠਿਆਂ ਦੇ ਨਾਲ ਹੀ ਕੋਕ ਦਾ ਓਰਡਰ ਵੀ ਆ ਕੋਕ ਵੀ ਆ ਜਾਵੇ ਘਰ ਘ ਤਾਂ ਕਿ ਮੈਨੂੰ ਬਹੁਤਾ ਆਪਣਾ ਜਿਹੜਾ ਹੈ ਉਹ ਸਮਾਂ ਬਰਬਾਦ ਨਾ ਕਰਨਾ ਪਵੇ ਮੈਂ ਪਹਿਲੇ ਜਿਹੜਾ ਹੈ ਉਹ ਕੋਕ ਦਾ ਓਰਡਰ ਨਹੀਂ ਸੀ ਤੁਹਾਨੂੰ ਕੀਤਾ ਮੈਂ ਭੁੱਲ ਗਈ ਸੀ ਓਰਡਰ ਕਰਨਾ ਜਦਕਿ ਹੁਣ ਮੈਂ ਦੁਬਾਰਾ ਤੁਹਾਡੇ ਕੋਲ ਇਹ ਓਨਲਾਈਨ ਓਰਡਰ ਕਰ ਰਹੀ ਹਾਂ ਆਪ ਨੇ ਜਿਹੜਾ ਉਹ ਸਲਾਦ ਵਗੈਰਾ ਨਾਲ ਭੇਜਣਾ ਹੈ ਉਸ ਦੇ ਨਾਲ ਹੀ ਕੋਕ ਦਾ ਵੀ ਓਰਡਰ ਆਪਣਾ ਮੇਰਾ ਐਕਸੈਪਟ ਕਰ ਲਵੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਵੇਗਾ ਜੇ ਤੁਸੀਂ ਭੋਜਨ ਦੇ ਨਾਲ ਕੋਕ ਵੀ ਮੈਨੂੰ ਭੇਜ ਦੇਵੋ ਇਹ ਮੇਰੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਮੈਨੂੰ ਭੋਜਨ ਦੇ ਨਾਲ ਤੁਹਾਡੇ ਰੈਸਟੋਰੈਂਟ ਦਾ ਜਿਹੜਾ ਇਹ ਭੋਜਨ ਹੈ ਮੈਨੂੰ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ ਇਸ ਕਰਕੇ ਮੈਂ ਹਮੇਸ਼ਾ ਤੁਹਾਡੇ ਹੀ ਰੈਸਟੋਰੈਂਟ ਵਿੱਚ ਓਰਡਰ ਕਰਦੀ ਹੈ ਅਤੇ ਇਹੀ ਭੋਜਨ ਦੇ ਨਾਲ ਹੀ ਮੈਨੂੰ ਕੋਕ ਵੀ ਭੇਜ ਦਿਉ ਤਾਂ ਕਿ ਮੈਂ ਇਹਦੀ ਪੇਮੈਂਟ ਤੁਹਾਨੂੰ ਭੋਜਨ ਦੀ ਡਿਲੀਵਰੀ ਭੋਜਨ ਅਤੇ ਕੋਕ ਦੀ ਡਿਲੀਵਰੀ ਹੋਣ ਤੋਂ ਬਾਅਦ ਕਰ ਸਕਾਂ